ਮੇਰੇ ਕੋਲ ਅਜੇ ਤੱਕ ਕੋਈ ਵੀ ਕਾਰੋਬਾਰ ਨਹੀਂ ਹੈ ਮੈਂ ਪੜ੍ਹ ਰਿਹਾ ਹਾਂ ਮੈਂ ਗ੍ਰੈਜੂਏਸ਼ਨ ਕਰ ਰਿਹਾ ਹਾਂ ਜਿਸਦੇ ਵਜੋਂ ਉਸ ਤੋਂ ਬਾਅਦ ਹੀ ਕਾਰੋਬਾਰ ਸਟਾਰਟ ਹੋਣਾ ਹੈ ਹਾਲਾਂਕਿ ਮੈਂ ਆਪਣੇ ਪਿਤਾ ਜੀ ਅਤੇ ਆਪਣੇ ਤਾਏ ਦੇ ਮੁੰਡੇ ਨਾਲ ਕਾਰੋਬਾਰ ਕਰ ਰਿਹਾ ਹਾਂ ਅਤੇ ਮੈਨੂੰ ਪਤਾ ਹੈ ਕਿ ਕਿਸ ਤਰ੍ਹਾਂ ਬੈਂਕ ਆਪਣੀ ਸਹਾਇਤਾ ਕਰਦਾ ਹੈ ਇੱਕ ਵਾਰ ਦੀ ਗੱਲ ਕਿ ਮੇਰੇ ਪਿਤਾ ਜੀ ਨੂੰ ਵਿੱਤੀ ਸਹਾਇਤਾ ਵਜੋਂ ਉਹਨਾਂ ਨੇ ਡਾਇਰੀ ਫਾਰਮਿੰਗ ਸਟਾਰਟ ਕਰਨੀ ਸੀ ਉਹਨਾਂ ਨੇ ਬੈਂਕ ਤੋਂ ਲੋਨ ਪ੍ਰੋਵਾਈਡ ਕੀਤਾ ਅਤੇ ਇਸ ਸਹਾਇਤਾ ਵਿੱਚ ਬੈਂਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਦਦ ਕੀਤੀ ਯਾਨੀ ਕਿ ਜ਼ੀਰੋ ਰੇਟ ਇੰਟਰਸਟ 'ਤੇ ਵੀ ਬੈਂਕ ਲੋਨ ਪ੍ਰੋਵਾਈਡ ਕੀਤਾ ਮੇਰੇ ਤਾਏ ਦੇ ਮੁੰਡੇ ਨੂੰ ਵੀ ਫਾਸਟ ਫੂਡ ਦਾ ਕੰਮ ਕਰਨਾ ਸੀ ਜਿਸ ਦੇ ਵਜੋਂ ਉਸ ਨੇ ਪੰਜ ਛੇ ਮਹੀਨੇ ਕੰਮ ਕਰਕੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਵਿੱਤੀ ਸਹਾਇਤਾ ਦੀ ਲੋੜ ਪਈ ਅਤੇ ਬੈਂਕ ਨੇ ਲੋਨ ਲੋਨ ਦਿੱਤਾ ਅਤੇ ਹੌਲੀ ਹੌਲੀ ਮੇਰੇ ਤਾਏ ਦੇ ਮੁੰਡੇ ਨੇ ਬੈਂਕ ਬੈਂਕ ਦਾ ਲੋਨ ਹੌਲੀ ਹੌਲੀ ਉਤਾਰ ਦਿੱਤਾ ਅਤੇ ਜਿਸ ਦੇ ਵਜੋਂ ਘੱਟ ਵਿਆਜ 'ਤੇ ਹੀ ਉਸ ਨੂੰ ਰਕਮ ਭਰਨੀ ਪਈ ਮੂਲਧਨ ਵਿਆਜ ਅਤੇ ਮੂਲਧਨ ਵਿਆਜ ਵੀ ਰਕਮ ਲੋਟਾ ਦੇਣੀ ਪੈਂਦੀ ਹੈ ਬੈਂਕ ਬਹੁਤ ਸਾਰੀਆਂ ਮਦਦ ਕਰਦਾ ਹੈ ਜਿਵੇਂ ਕਿ ਬੈਂਕ ਕਰੰਟ ਅਕਾਊਂਟ ਖੋਲ੍ਹਣ ਦੀ ਵੀ ਮਦਦ ਕਰਦਾ ਹੈ ਜਿਸ ਨਾਲ ਅਸੀਂ ਆਪਣੀ ਵਿੱਤੀ ਸਹਾਇਤਾ ਨੂੰ ਕਢਵਾ ਜਾਂ ਜਮ੍ਹਾਂ ਕਰਵਾ ਸਕਦੇ ਹਾਂ ਇਸ ਵਿੱਚ ਰਾਸ਼ੀ ਬੈਂਕ ਹੌਲੀ ਹੌਲੀ ਲੈਂਦਾ ਹੈ ਅਤੇ ਅ ਸਾਨੂੰ ਜ਼ਿਆਦਾ ਕਾਹਲੀ ਕਰਨ ਦੀ ਵੀ ਨਹੀਂ ਲੋੜ ਪੈਂਦੀ ਜਿਸ ਨਾਲ ਅਸੀਂ ਬੈਂਕ ਵਿੱਚ ਤੇ ਜ਼ਿਆਦਾ ਤੋਂ ਜ਼ਿਆਦਾ ਡਿਪੋਜਿਟ ਕਰਵਾ ਸਕਦੇ ਹਾਂ ਇਸ ਲਈ ਬੈਂਕ ਸਾਡੀ ਨਿੱਜੀ ਜ਼ਿੰਦਗੀ ਵਿੱਚ ਅਤੇ ਕਾਰੋਬਾਰ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸਹਾਇਕ ਹਨ ਕਾਰੋਬਾਰ ਵਿੱਚ ਬੈਂਕ ਇੱਕ ਬੈਂਕ ਇੱਕ ਸਬੂਤ ਵਜੋਂ ਮੰਗਦਾ ਹੈ ਅਤੇ ਜਿਸ ਵਿੱਚ ਜਦੋਂ ਅਸੀਂ ਸਬੂਤ ਦੇ ਦਿੰਦੇ ਹਾਂ ਤਾਂ ਬੈਂਕ ਸਾਨੂੰ ਲੋਨ ਮਿਲ ਜਾਂਦਾ ਹੈ ਇਸ ਵਿੱਚ ਕਾਰੋਬਾਰ ਮਾਮਲਿਆਂ ਵਿੱਚ ਬੈਂਕ ਬਹੁਤ ਜ਼ਿਆਦਾ ਸਹਾਇਕ ਸਿੱਧ ਹੈ